ਹਾਂਜੀ ਪੰਜਾਬ ਦੇ ਸੱਭਿਆਚਾਰਕ ਜਿਵੇਂ ਮੇਲੇ ਹੋ ਗਏ ਆ ਉਨ ਉਹਨਾਂ ਦੇ ਵਿੱਚ ਜੋ ਵੀ ਗੰਦੇ ਗਾਣੇ ਜਾਂ ਕੁਛ ਵੀ ਐਵੇਂ ਦੀਆਂ ਚੀਜਾਂ ਜੋ ਸਮਾਜ ਨੂੰ ਨਾ ਪਸੰਦ ਹੋਣ ਉਹ ਚੀਜ਼ਾਂ ਵਰਜਿਤ ਕੀਤੀਆਂ ਜਾਂਦੀਆਂ ਅਤੇ ਜਿਵੇਂ ਹੋ ਗਏ ਹਥਿਆਰ ਵਗੈਰਾ ਹੋ ਗਏ ਉਹ ਸਭ ਇਹ ਸੱਭਿਆਚਾਰਕ ਤੋਂ ਉਲਟ ਹੈਗੇ ਹੈ ਇਹ ਸਮਾਜ ਦੇ ਸਮਾਜ ਦੇ ਨਿਯਮ ਤੋਂ ਉਲਟ ਹੈਗੇ ਆ ਇਹਨਾਂ ਨੂੰ ਵਰਜਿਤ ਕੀਤਾ ਜਾਂਦਾ ਹੈ